ਅਸੀਂ ਆਪਣੇ ਬਗ਼ੀਚੇ ਵਿੱਚ ਪੌਦੇ ਲਾਉਣ ਲਈ ਜ਼ਿਆਦਾਤਰ ਬੀਜ ਆਪਣੇ ਹੀ ਪੌਦਿਆਂ ਤੋਂ ਤਿਆਰ ਕਰਦੇ ਹਾਂ ਅਤੇ ਕੁਛ ਥੋੜ੍ਹੇ ਬਹੁਤ ਬੀਜ ਨਵੇਂ ਕਿਸਮ ਦੇ ਬੀਜ ਜੋ ਆਉਂਦੇ ਹਨ ਉਹ ਬਜ਼ਾਰ ਤੋਂ ਜਾਂ ਦੁਕਾਨਦਾਰ ਦੁਕਾਨਦਾਰ ਤੋਂ ਵੀ ਲੈ ਕੇ ਆਉਂਦੇ ਹਨ